ਕੱਤੀ ਜੁਲਾਈ ਉੱਨੀ ਸੌ ਪਚੱਨਵੇ ਉਣੱਤੀ ਮਾਰਚ ਉੱਨੀ ਸੌ ਤੇਹੱਤਰ ਕੱਤੀ ਮਾਰਚ ਉੱਨੀ ਸੌ ਪਚੱਨਵੇ ਚੋਵੀ ਅਕਤੂਬਰ ਦੋ ਹਜ਼ਾਰ ਇੱਕ ਤਿੰਨ ਸਤੰਬਰ ਦੋ ਹਜ਼ਾਰ ਤੇਈ